ਮੈਂ ਬਚਪਨ ਤੋਂ ਹੀ ਬਹੁਤ ਸਾਰੇ ਡਾਂਸ ਮੁਕਾਬਲਿਆਂ ਵਿੱਚ ਹਿੱਸੇ ਲਏ ਹਨ ਜਦੋਂ ਮੈਂ ਤੀਸਰੀ ਜਾਂ ਚੌਥੀ ਜਮਾਤ ਵਿੱਚ ਪੜ੍ਹਦੀ ਸੀ ਮੈਂ ਸਕੂਲ ਵਿੱਚ ਕਰਵਾਏ ਜਾਣ ਵਾਲੇ ਸਵਤੰਤਰਤਾ ਦਿਵਸ ਗਣਤੰਤਰ ਦਿਵਸ ਯੂਥ ਫੈੱਸਟੀਵਲ ਅਤੇ ਹੋਰਨਾਂ ਸੱਭਿਆਚਾਰਕ ਪ੍ਰੋਗਰਾਮਾਂ ਵਿੱਚ ਹਿੱਸੇ ਲੈਂਦੀ ਸੀ ਮੈਂ ਪੰਜਾਬ ਦਾ ਲੋਕ ਨਾਚ ਗਿੱਧਾ ਬਹੁਤ ਵਾਰ ਸਟੇਜ 'ਤੇ ਪ੍ਰਫੋਰਮ ਕੀਤਾ ਦੇਸ਼ ਭਗਤੀ ਦੇ ਗੀਤਾਂ 'ਤੇ ਫਾਂਸੀ ਬਣ ਕੇ ਸਟੇਜ ਪ੍ਰਫੋਰਮੈਂਸ ਦਿੱਤੀ ਧਾਰਮਿਕ ਪ੍ਰੋਗਰਾਮਾਂ ਜਿਵੇਂ ਕ੍ਰਿਸ਼ਨ ਜਨਮਾਸ਼ਟਮੀ ਦੇ ਮੌਕੇ 'ਤੇ ਹਰ ਸਾਲ ਸ਼੍ਰੀ ਰਾਧਾ ਰਾਣੀ ਦਾ ਰੋਲ ਨਿਭਾਇਆ ਤੇਰ੍ਹਾਂ ਅਪ੍ਰੈਲ ਉੱਨੀ ਸੌ ਉੱਨੀ ਜਲ੍ਹਿਆਂਵਾਲੇ ਬਾਗ ਦਾ ਸਾਕਾ ਸਿਰਜ ਕੇ ਸਟੇਜ ਪ੍ਰਫੋਰਮੈਂਸ ਦਿੱਤੀ ਅਤੇ ਬਹੁਤ ਵਾਰ ਵਾਰਿਸ ਸ਼ਾਹ ਬੁੱਲ੍ਹੇ ਸ਼ਾਹ ਆਦਿ ਦੇ ਕਿੱਸਿਆਂ ਨੂੰ ਬਿਆਨ ਕਰਦੀਆਂ ਰਚਨਾਵਾਂ ਪੇਸ਼ ਕੀਤੀਆਂ ਅਤੇ ਬਹੁਤ ਬਖੂਬੀ ਰੋਲ ਨਿਭਾਏ